ਸਾਡੇ ਪੰਜਾਬ ਰਾਜ ਵਿੱਚ ਬਹੁਤ ਸਾਰੀਆਂ ਕਲਾ ਸ਼ੈਲੀਆਂ ਹਨ ਜਿਵੇਂ ਕਿ ਮਿੱਟੀ ਦੇ ਬਰਤਨ ਬਣਾਉਣਾ ਮੂਰਤੀਆਂ ਬਣਾਉਣਾ ਫੁੱਲ ਬੂਟੇ ਬਣਾਉਣਾ ਤਸਵੀਰਾਂ ਬਣਾਉਣਾ ਜਾਂ ਹੋਰ ਗੇਲ ਘਰੇਲੂ ਸਜਾਵਟ ਦਾ ਸਮਾਨ ਬਣਾਉਣਾ ਗਮਲੇ ਬਣਾਉਣਾ ਸਾਨੂੰ ਇੱਕ ਜਗ੍ਹਾ ਜਾਂ ਮਕਾਨ ਚਾਹੀਦਾ ਹੁੰਦਾ ਹੈ ਤਾਂ ਉਸ ਜਗ੍ਹਾ 'ਤੇ ਅਸੀਂ ਆਰਾਮ ਨਾਲ ਆਪਣੀ ਕਲਾ ਸ਼ੈਲੀ ਦਾ ਪ੍ਰਯੋਗ ਕਰਕੇ ਕੰਮ ਕਰ ਸਕਦੇ ਹਾਂ ਅਸੀਂ ਆਪਣੀ ਕਲਾ ਸ਼ੈਲੀ ਦੂਸਰੇ ਦੇਸ਼ਾਂ ਨੂੰ ਦਿਖਾਉਣ ਲਈ ਕਲਾ ਪ੍ਰਦਰਸ਼ਨੀ ਲਗਾਉਂਦੇ ਹਾਂ ਕਿਉਂਕਿ ਇਹਨਾਂ ਇਹਨਾਂ ਕਲਾਵਾਂ ਵਿੱਚ ਸਾਡੇ ਪੰਜਾਬ ਜਾਂ ਭਾਰਤ ਦਾ ਸੱਭਿਆਚਾਰ ਛਿਪਿਆ ਹੁੰਦਾ ਹੈ ਜਿਸ ਰਾਹੀਂ ਲੋਕਾਂ ਜਾਂ ਵਿਦੇਸ਼ਾਂ ਤੱਕ ਸਾਡਾ ਸੱਭਿਆਚਾਰ ਪਹੁੰਚਦਾ ਹੈ ਇਸ ਕਲਾ ਸ਼ੈਲੀਆਂ ਸਾਡੀ ਸਖਤ ਮਿਹਨਤ ਦਾ ਨਤੀਜਾ ਹੈ